ਪੁਰਾਣੇ ਸਮੇਂ ਦੇ ਲੋਕ ਰੱਬ ਨੂੰ ਮੰਨਣ ਵਿੱਚ ਬਹੁਤ ਸ਼ਰਧਾ ਰੱਖਦੇ ਸਨ ਉਹ ਸਵੇਰੇ ਉੱਠ ਕੇ ਪਾਠ ਕਰਦੇ ਅਤੇ ਗੁਰਦੁਆਰੇ ਜਾਂਦੇ ਅਤੇ ਲੰਗਰ ਲਗਾਉਂਦੇ ਜਿਸ ਨਾਲ ਭੁੱਖਾ ਮਰੇ ਲੋਕਾਂ ਦੀ ਵੀ ਸਹਾਇਤਾ ਹੋ ਜਾਂਦੀ ਇਸਦੇ ਅਨੁਸਾਰ ਦੇਖਿਆ ਜਾਵੇ ਤਾਂ ਨਵੀ ਛੋਟੀਆਂ ਪੀੜ੍ਹੀਆਂ ਜਿਵੇਂ ਕਿ ਅੱਜ ਕੱਲ੍ਹ ਦੇ ਲੋਕ ਜਿਹਨਾਂ ਕੋਲ ਬਹੁਤ ਘੱਟ ਸਮਾਂ ਹੈ ਅਤੇ ਉਹ ਗੁਰਦੁਆਰੇ ਮੰਦਰ ਜਾ ਨਹੀਂ ਪਾਉਂਦੇ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸੀਰੀਅਸਨੈੱਸ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਉਹ ਰੱਬ ਨੂੰ ਮੰਨਣ ਵਿੱਚ ਸੀਰੀਅਸ ਨਹੀਂ ਹਨ